ਹਾਂਜੀ ਮੈਨੂੰ ਪੈਨ ਨਾਲ ਕਾਗਜ਼ 'ਤੇ ਲਿਖਣਾ ਬਹੁਤ ਜ਼ਿਆਦਾ ਪਸੰਦ ਹੈ ਮੋਬਾਇਲ 'ਤੇ ਟਾਈਪ ਕਰਨਾ ਵੀ ਆਉਂਦਾ ਪਰ ਪੈਨ ਨਾਲ ਲਿਖਣ 'ਤੇ ਮੈਨੂੰ ਲੱਗਦਾ ਜੋ ਵਿਦਿਆਰਥੀ ਵਰਗ ਹੈ ਪੈਨ ਨਾਲ ਕ ਕਾਗਜ਼ 'ਤੇ ਪੈਨ ਦੀ ਵਰਤੋਂ ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਲਿਖਣ ਨਾਲ ਜੋ ਗਿਆਨ ਹੈ ਉਹ ਕਹਿੰਦੇ ਪੱਕਾ ਹੋ ਜਾਂਦਾ ਤਾਂ ਪੈਨ ਅਤੇ ਕਾਗਜ਼ ਦੀ ਜਗ੍ਹਾ ਤਾਂ ਨਹੀਂ ਕੋਈ ਚੀਜ਼ ਹੋਰ ਲੈ ਸਕਦੀ ਪਰ ਇਹ ਹੈ ਕਿ ਅੱਜ ਕੱਲ੍ਹ ਮੋਬਾਈਲ ਦਾ ਚਲਣ ਬਹੁਤ ਜ਼ਿਆਦਾ ਹੋ ਗਿਆ ਅਤੇ ਮਿੰਟਾਂ ਸਕਿੰਟਾਂ 'ਚ ਟਾਈਪਿੰਗ ਹੋ ਜਾਂਦੀ ਹੈ ਪਰ ਇਸ ਟਾਈਪਿੰਗ ਨੇ ਜੋ ਲਫਜ਼ਾਂ ਨੂੰ ਸ਼ੋਰਟਕੱਟ ਦੇ ਵਿੱਚ ਬਦਲ ਦਿੱਤਾ ਉਹਦੇ ਨਾਲ ਭਾਸ਼ਾ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਕਿਉਂਕਿ ਲੋਕ ਜ਼ਿਆਦਾਤਰ ਸ਼ੋਰਟਕੱਟ ਚੱਲਦੇ ਨੇ ਸ਼ੋਰਟਕੱਟ ਦੇ ਕਾਰਨ ਹੀ ਭਾਸ਼ਾ ਖਰਾਬ ਹੋ ਰਹੀ ਹੈ ਅਤੇ ਸਮਾਂ ਜ਼ਰੂਰ ਬੱਚਦਾ ਬਟ ਪਰ ਚਿੰਤਾ ਦੀ ਗੱਲ ਇਹ ਹੈ ਕਿ ਭਾਸ਼ਾ ਨੂੰ ਹੋਰ ਹੀ ਸ਼ੋਰਟਕੱਟਸ ਦੇ ਵਿੱਚ ਲਿਖਿਆ ਜਾ ਰਿਹਾ ਅਤੇ ਦੂਸਰਾ ਕੋਈ ਪੰਜਾਬੀ 'ਚ ਟਾਈਪ ਕਰਨਾ ਪਸੰਦ ਨਹੀਂ ਕਰਦਾ ਬਹੁਤ ਘੱਟ ਲੋਕ ਹੋਣਗੇ ਜਿਹੜੇ ਪੰਜਾਬੀ 'ਚ ਟਾਈਪ ਕਰਦੇ ਨੇ ਜਾਂ ਤਾਂ ਉਹ ਥੋੜ੍ਹਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਸੱਤਰ ਅੱਸੀ ਵਾਲੇ ਹੋਣਗੇ ਸੱਤਰ ਅੱਸੀ ਵਾਲੇ ਵੀ ਮੈਂ ਕਹਿ ਹੀ ਰਹੀ ਹਾਂ ਬਟ ਮੈਨੂੰ ਲੱਗਦਾ ਪੰਜਾਹ ਸੱਠ ਵਾਲੇ ਉਮਰ ਵਰਗ ਦੇ ਨੇ ਉਹ ਪੰਜਾਬੀ 'ਚ ਟਾਈਪ ਕਰਨਾ ਪਸੰਦ ਕਰਦੇ ਹੋਣਗੇ ਅਤੇ ਅੱਜ ਕੱਲ੍ਹ ਦੇ ਨੌਜਵਾਨ ਤਾਂ ਇੰਗਲਿਸ਼ ਨੂੰ ਹੀ ਜ਼ਿਆਦਾ ਮਹੱਤਤਾ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਲਿਖਣੀ ਉਹ ਸੌਖੀ ਲੱਗਦੀ ਹੈ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਜੋ ਇਹ ਮੋਬਾਈਲ 'ਤੇ ਟਾਈਪ ਹੈ ਠੀਕ ਹੈ ਸਮਾਂ ਬਚਾਉਂਦਾ ਕੁਛ ਹੱਦ ਤੱਕ ਠੀਕ ਹੈ ਪਰ ਪੈਨ ਅਤੇ ਕਾਗਜ਼ ਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹ ਆਪਣੇ ਗਿਆਨ ਨੂੰ ਹੋਰ ਵਧਾਉਂਦੇ ਨੇ ਧੰਨਵਾਦ